ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਅਪਰਾਧ ਵੱਧ ਗਏ ਹਨ ਬਹੁਤ ਸਾਰੀਆਂ ਚੋਰੀਆਂ ਅਤੇ ਕਤਲ ਹੋਣ ਲੱਗ ਗਏ ਹਨ ਚੋਰੀਆਂ ਦੇ ਵੱਧਣ ਕਾਰਨ ਲੋਕਾਂ ਦੇ ਵਿੱਚ ਡਰ ਪੈਦਾ ਹੋ ਰਿਹਾ ਹੈ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਿਕਿਉਰਟੀ ਵਧਾਈ ਜਾਵੇ ਆਬਾਦੀ ਦੇ ਆਬਾਦੀ ਜਨਸੰਖਿਆ ਵੱਧਣ ਕਾਰਨ ਇਹ ਬਹੁਤ ਸਾਰੀਆਂ ਚੋਰੀਆਂ ਹੋਣ ਲੱਗ ਗਈਆਂ ਹਨ ਨਸ਼ੇ ਦੇ ਵੱਧਣ ਕਾਰਨ ਵੀ ਇਹ ਚੋਰੀਆਂ ਨੂੰ ਤਰਜੀਹ ਮਿਲਦੀ ਹੈ ਇਸ ਕਰਕੇ ਮੈਂ ਇਹ ਸਿਕਿਉਰ ਮੈਂ ਇਹ ਬੇਨਤੀ ਕਰਦਾ ਹਾਂ ਕਿ ਸਿਕਿਉਰਟੀ ਵਧਾਈ ਜਾਵੇ ਜਿਸ ਕਾਰਨ ਚੋਰੀਆਂ ਰੁੱਕ ਸਕਣ ਮੈਂ ਮੈਂ ਹੀ